ਸਤਾਰ੍ਹਾਂ ਅਪ੍ਰੈਲ ਦੋ ਹਜ਼ਾਰ ਦੋ ਚਾਰ ਦਸੰਬਰ ਦੋ ਹਜ਼ਾਰ ਦੋ ਇੱਕ ਜਨਵਰੀ ਦੋ ਹਜ਼ਾਰ ਵੀਹ ਚਾਰ ਜਨਵਰੀ ਦੋ ਹਜ਼ਾਰ ਇੱਕੀ ਪੰਜ ਜਨਵਰੀ ਦੋ ਹਜ਼ਾਰ ਬਾਈ